ਪੰਜਾਬ ਦੇ ਪ੍ਰਮੁੱਖ ਤਿਉਹਾਰ ਹਨ ਲੋਹੜੀ ਅਤੇ ਵਿਸਾਖੀ ਲੋਹੜੀ ਦਾ ਜੋ ਤਿਉਹਾਰ ਹੈ ਉਹ ਜਨਵਰੀ ਦੇ ਮਹੀਨੇ ਵਿੱਚ ਹਰ ਸਾਲ ਆਉਂਦਾ ਹੈ ਜਿਸ ਵਿੱਚ ਲੋਕ ਆਪਣੇ ਵਿਆਹ ਦਾ ਅਗਰ ਜਾਂ ਕੋਈ ਕਿਸੇ ਘਰ 'ਚ ਬੱਚਾ ਜੰਮਿਆ ਹੈ ਤਾਂ ਉਹਦੀ ਲੋਹੜੀ ਵਾਲੀ ਜਾਂਦੀ ਹੈ ਲੋਹੜੀ ਵਾਲੇ ਦਿਨ ਲ ਲੋਕ ਆਪਣੇ ਰਿਸ਼ਤੇਦਾਰ ਨੂੰ ਇਕੱਠੇ ਕਰਕੇ ਉੱਥੇ ਲੋਹੜੀ ਅੱਗ ਬਾਲ ਕੇ ਅਤੇ ਆਲੇ ਦੁਆਲੇ ਅੱਗ ਦੇ ਭੰਗੜਾ ਪਾਉਂਦੇ ਹਨ ਖੁਸ਼ੀਆਂ ਮਨਾਉਂਦੇ ਹਨ ਅਤੇ ਇਸੇ ਤਰ੍ਹਾਂ ਜਦੋਂ ਵਿਸਾਖੀ ਦਾ ਤਿਉਹਾਰ ਆਉਂਦਾ ਹੈ ਵਿਸਾਖੀ 'ਤੇ ਲੋਕ ਗੁਰੂ ਘਰਾਂ 'ਚ ਨਤਮਸਤਕ ਹੁੰਦੇ ਹਨ ਅਤੇ ਉਸ ਤੋਂ ਬਾਅਦ ਆਪਣੇ ਮਨੋਰੰਜਨ ਵਾਸਤੇ ਹਰ ਜਗ੍ਹਾ ਵੱਖ ਵੱਖ ਪ੍ਰੋਗਰਾਮ ਜਿਵੇਂ ਸੱਭਿਆਚਾਰਕ ਪ੍ਰੋਗਰਾਮ ਕਰਾਉਂਦੇ ਹਾਂ ਜਿਸ ਵਿੱਚ ਲੋਕ ਆਪਣਾ ਹਰ ਉਮਰ ਦੇ ਲੋਕ ਬੱਚੇ ਜਵਾਨ ਅਤੇ ਬੁੱਢੇ ਸਾਰੇ ਹੀ ਇਸ ਵਿੱਚ ਆਪਣਾ ਪੂਰਾ ਇੰਜੋਏ ਕਰਦੇ ਹਨ